ਪੰਜਾਬੀ ਭਾਸ਼ਾ ਜਿਹੜੀ ਆ ਪੰਜਾਬ ਦੀ ਮਾਤ ਭਾਸ਼ਾ ਆ ਇਹ ਪੰਜਾਬੀ ਭਾਸ਼ਾ ਇੱਕ ਇਹੋ ਜਿਹੀ ਆ ਜਿਹੜੇ ਪੰਜਾਬ ਦੇ ਵ ਵਸਨੀਕ ਆ ਉਹ ਭਾਵੇਂ ਜਿੱਥੇ ਵੀ ਰਹਿਣ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਜਿਹੜਾ ਵਾ ਅੱਗੇ ਕਿਸੇ ਅੱਗੇ ਵਿਅਕਤ ਕਰਨ ਵਿੱਚ ਉਹਨਾਂ ਨੂੰ ਆਸਾਨੀ ਹੁੰਦੀ ਆ ਮਾਤ ਭਾਸ਼ਾ ਦੇ ਵਿੱਚ ਕੀ ਆ ਕੀ ਇਹਦੇ ਵਿੱਚ ਪੰਜਾਬੀ ਜਿਹੜੇ ਆ ਆਪਣੇ ਜਿਹੜੇ ਖੁਸ਼ੀ ਗਮੀ ਜਿਹੜੀ ਆ ਉਹ ਕੀ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਹੀ ਜਿਹੜੀ ਆ ਇੱਕ ਦੂਜੇ ਨੂੰ ਵੰਡਦੇ ਆ ਖੁਸ਼ੀਆਂ ਵੰਡਦੇ ਨੇ ਗਮ ਜਿਹੜੇ ਵੰਡਦੇ ਨੇ ਅਤੇ ਜਿਹੜੀ ਅ ਪੰਜਾਬੀ ਲੋਕ ਗੀਤ ਆ ਜਿਹੜਾ ਆਪਣੇ ਅ ਵਿਰਾਸਤੀ ਜਿਹੜੇ ਹੈਗੇ ਸੀ ਗੁਰੂ ਪੀਰਾਂ ਦੀ ਜਿਹੜੀ ਭਾਸ਼ਾ ਵਾ ਉਹਨਾਂ ਨੇ ਇਹਨੂੰ ਗੁਰਮੁਖੀ ਦਾ ਰੂਪ ਦਿੱਤਾ ਸੀਗਾ ਅਤੇ ਉਹਦੇ ਨਾਲ ਕੀ ਆ ਉਹ ਜਿਹੜਾ ਹੁਣ ਇੰਨਾ ਜ਼ਿਆਦਾ ਪ੍ਰਚੱਲਤ ਹੋ ਚੁੱਕੀ ਹੈ ਪੰਜਾਬੀ ਕਿ ਦੇਖੋ ਅੱਜ ਕੱਲ੍ਹ ਭਾਵੇਂ ਮਾਡਰਨ ਜਮਾਨਾ ਆ ਕਿ ਬਾਹਰਲੀ ਕੰਟਰੀ 'ਚ ਕੈਨੇਡਾ ਵਗੈਰਾ 'ਚ ਵੀ ਜਿਹੜੇ ਪੰਜਾਬੀ ਇੱਥੋਂ ਜਿਹੜੇ ਜਾ ਰਹੇ ਨੇ ਮਾਈਗ੍ਰੇਟ ਕਰਦੇ ਪਏ ਨੇ ਆਪਣੀ ਮਤਲਬ ਉੱਚ ਪੱਧਰ ਦੀ ਪੜਾਈਆਂ ਦੇ ਲਈ ਉਹ ਬਾਹਰ ਜਾਵੇ ਜਿੱਥੇ ਜਿੱਥੇ ਮਤਲਬ ਪੰਜਾਬੀ ਜਿਹੜੇ ਵੱਸਦੇ ਪਏ ਆ ਉਹ ਪੰਜਾਬੀ ਦਾ ਹੀ ਉਪਯੋਗ ਕਰਦੇ ਨੇ ਇੱਥੋਂ ਤੱਕ ਕੀ ਹੁਣ ਦੇਖੋ ਕਿ ਜਿਸ ਤਰ੍ਹਾਂ ਸਿੰਗਰ ਆ ਆਪਣੇ ਭਾਵੇਂ ਬਾਹਰ ਜਾਣ ਭਾਵੇਂ ਜਿੱਥੇ ਮਰਜ਼ੀ ਜਾਣ ਗਾਣੇ ਪੰਜਾਬੀ 'ਚ ਲਿਖਦੇ ਨੇ ਇਹਦੇ ਨਾਲ ਕੀ ਹੈ ਖੁਸ਼ੀ ਦੀ ਜਿਹੜੀ ਦੁਗਣੀ ਹੋ ਜਾਂਦੀ ਆ ਵੇਖੋ ਉਸ ਤਰ੍ਹਾਂ ਗੀਤ ਅਤੇ ਜਿਹੜੇ ਬਹੁਤ ਸਾਰੇ ਹੁੰਦੇ ਨੇ ਹਿੰਦੀ 'ਚ ਵੀ ਬੋਲਦੇ ਆ ਜੇ ਅ ਆਪਣੇ ਅੰਗਰੇਜ਼ ਨੇ ਉਹ ਕੀ ਆ ਇੰਗਲਿਸ਼ ਦੇ ਗਾਣੇ ਵੀ ਉਹ ਇੰਗਲਿਸ਼ 'ਚ ਬੋਲਦੇ ਨੇ ਪਰ ਦੇਖੋ ਕਿ ਪੰਜਾਬੀ ਜਿਹੜੇ ਗਾਣੇ ਦੀ ਆਪਣੀ ਵੱਖਰੀ ਪਛਾਣ ਹੁੰਦੀ ਆ ਇਹ 'ਚ ਕੀ ਆ ਉਹਨਾਂ ਦਾ ਇੱਕ ਉਤਸਾਹ ਭਰਿਆ ਹੁੰਦਾ ਦੇਖੋ ਲੋਕ ਗੀਤ ਆ ਇੰਨਾ ਸਭ ਕੁਛ ਆਪਣੇ ਲਿਟਰੇਚਰ ਆਪਣਾ ਦੇਖੋ ਕਿ ਸਾਰਾ ਪੰਜਾਬੀ ਦੇ ਵਿੱਚ ਆ ਅਤੇ ਦੇਖੋ ਕਿ ਇਹ ਹਰ ਹੁਣ ਜਿਹੜੇ ਹਿੰਦੀ ਵਾਲੇ ਆ ਉਹ ਉਹਨਾਂ ਨੇ ਵੀ ਆਪਣੀਆਂ ਫਿਲਮਾਂ ਦੇ ਵਿੱਚ ਪੰਜਾਬੀ ਡਾਇਲੋਗ ਬੋਲਣੇ ਸ਼ੁਰੂ ਕਰ ਦਿੱਤੇ ਨੇ ਕਿ ਇਹਨਾਂ ਜ਼ਿਆਦਾ ਜਿਹੜੀ ਪੰਜਾਬੀ ਜਿਹੜੀ ਆ ਫੇਮਸ ਹੋ ਚੁੱਕੀ ਆ ਪੂਰੇ ਵਰਲਡ ਦੇ ਵਿੱਚ